ਪੰਜਾਬੀ ਸੱਭਿਆਚਾਰ ਨੂੰ ਭੰਗੜੇ ਤੋਂ ਅਲੱਗ ਕਰਕੇ ਦੇਖਿਆ ਹੀ ਨਹੀਂ ਜਾ ਸਕਦਾ ਕਿਉਂਕਿ ਜਿਹੜੀ ਪੰਜਾਬੀ ਸੱਭਿਆਚਾਰ ਦੀਆਂ ਮੁੱਖ ਨਿਸ਼ਾਨੀਆਂ ਨੇ ਉਨ੍ਹਾਂ ਵਿੱਚੋਂ ਭੰਗੜੇ ਨੂੰ ਇੱਕ ਖ਼ਾਸ ਥਾਂ ਦਿੱਤੀ ਗਈ ਹੈ ਕਿ ਜਿਹੜੇ ਵੀ ਪੰਜਾਬ ਦੇ ਤਿਉਹਾਰ ਨੇ ਜਾਂ ਮੇਲੇ ਨੇ ਜਾਂ ਵਿਆਹਾਂ ਸ਼ਾਦੀਆਂ ਦੇ ਮੌਕੇ ਨੇ ਸਭ ਉੱਤੇ ਭੰਗੜਾ ਪਾਇਆ ਜਾਂਦਾ ਇਸ ਤੋਂ ਇਲਾਵਾ ਜਿਹੜੇ ਫ਼ਿਲਮੀ ਗੀਤ ਨੇ ਫ਼ਿਲਮਾਂ ਆਉਂਦੀਆਂ ਨੇ ਪੋਲੀਵੁੱਡ ਦੀਆਂ ਅਤੇ ਬੋਲੀਵੁੱਡ ਦੀਆਂ ਫ਼ਿਲਮਾਂ 'ਚ ਵੀ ਅੱਜ ਕੱਲ੍ਹ ਭੰਗੜਾ ਦਿਖਾਇਆ ਜਾਂਦਾ ਹੈ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ